ਤੇਰਾਂ ਮਾਰਚ ਉੱਨੀ ਸੌ ਚੁਹੱਤਰ ਇੱਕ ਨਵੰਬਰ ਉੱਨੀ ਸੌ ਉਣਾਸੀ ਅਠਾਰਾਂ ਦਸੰਬਰ ਦੋ ਹਜ਼ਾਰ ਅੱਠ ਸੋਲਾਂ ਜੂਨ ਦੋ ਹਜ਼ਾਰ ਬਾਰਾਂ ਬਾਰਾਂ ਅਗਸਤ ਦੋ ਹਜ਼ਾਰ ਉੱਨੀ